ਮੈਂ ਐਮਾਜ਼ੋਨ ਤੋਂ ਇੱਕ ਕੇ ਪਾਵਰ ਬੈਂਕ ਔਡਰ ਕੀਤਾ ਸੀਗਾ ਜੀ ਜਿਹਦੇ ਨਾਲ ਜੋ ਕਿ ਕੁਛ ਦਿਨਾਂ ਵਿੱਚ ਖਰਾਬ ਹੋ ਗਿਆ ਨਾ ਤਾਂ ਉਹਦੀ ਬਿਲਡ ਕੁਆਲਟੀ ਵਧੀਆ ਸੀਗੀ ਨਾ ਉਹਦਾ ਬੈਟਰੀ ਜਿਹੜੇ ਮੇਨ ਕੰਮ ਵਾਸਤੇ ਹੁੰਦਾ ਉਹ ਫ਼ੋਨ ਚਾਰਜ ਕਰਨੇ ਵਾਸਤੇ ਉਹ ਵੀ ਉਹ ਫ਼ੋਨ ਚਾਰਜ ਕਰ ਨਹੀਂ ਪਾ ਰਿਹਾ ਸੀਗਾ ਉਹ ਆਪ ਚਾਰਜ ਹੋਣੇ ਨੂੰ ਏ ਤਿੰਨ ਚਾਰ ਘੰਟੇ ਲੈ ਜਾਂਦਾ ਸੀਗਾ ਅਤੇ ਮੇਰਾ ਫ਼ੋਨ ਨੂੰ ਛੇ ਸੱਤ ਘੰਟੇ ਵਿੱਚ ਉਹ ਚਾਰਜ ਕਰਦਾ ਸੀਗਾ ਉਹ ਵੀ ਥੋੜ੍ਹੇ ਦਿਨ ਕੀਤਾ ਉਹਨੇ ਉਹ ਤੋਂ ਬਾਅਦ ਉਹ ਖਰਾਬ ਹੋ ਗਿਆ ਮੇਰਾ ਇਹਦੇ ਨ ਇਹਦੇ ਉੱਤੇ ਪੈਸੇ ਲਾਏ ਹੋਏ ਜਿਹੜੇ ਸੀਗੇ ਉਹ ਮੇਰੇ ਬਿਲਕੁਲ ਵੇਸਟ ਗਏ ਅਤੇ ਜਿਹੜਾ ਕੋਪਨੀ ਨਾਲ ਮੇਰਾ ਐਕਸਪੀਰੀਅੰਸ ਸੀਗਾ ਐਮਾਜ਼ੋਨ ਵਾਲ਼ਿਆਂ ਨਾਲ ਉਹ ਵੀ ਬਿਲ ਬਿਲਕੁਲ ਮਤਲਬ ਖਰਾਬ ਰਿਹਾ